ਹੈਲੋ ਸੰਜੀਵ ਸਿੰਘ ਜੀ ਤੁਹਾਡਾ ਕੀ ਹਾਲ ਹੈ ਮੈਂ ਤੁਹਾਡਾ ਦੋਸਤ ਦੀਪਕ ਸਮਿਆਲ ਜਿਵੇਂ ਕਿ ਮੈਂ ਜਾਣ ਦਿਆ ਹਾਂ ਕਿ ਤੁਹਾਡੇ ਘਰ ਕੁਝ ਦਿਨ ਪਹਿਲਾਂ ਜੁੜਵਾਂ ਬੱਚੇ ਹੋਏ ਸਨ ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਲੇਕਿਨ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਤੁਸੀਂ ਜਿਹੜੇ ਜੁੜਵਾਂ ਬੱਚੇ ਦੇ ਆ ਉਹਨਾਂ ਦੀਆਂ ਜਿਹੜੀਆਂ ਤੁਸੀਂ ਡੁਬਲੀਕੇਟ ਜਨਮ ਰਜਿਸਟਰੇਸ਼ਨ ਜਿਹੜੀ ਆ ਉਹ ਅਰਜ਼ੀਆਂ ਜਮ੍ਹਾਂ ਕਰਵਾਈਆਂ ਹਨ ਜੋ ਕਿ ਮੈਨੂੰ ਲੱਗਦਾ ਹੈ ਕਿ ਉਹਨੂੰ ਰੱਦ ਕਰਨ ਦੀ ਜ਼ਰੂਰਤ ਹੈ ਤਾਂ ਮੇਰੀ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਉਸ ਰਜਿਸਟ੍ਰੇਸ਼ਨ ਨੂੰ ਤੁਸੀਂ ਰੱਦ ਕਰਵਾ ਆਓ ਤਾਂ ਕਿ ਜਿਹੜੇ ਪੰਜਾਬ ਦੀ ਜਿਹੜੀ ਵੀ ਜਨਗਣਨਾ ਹੁੰਦੀ ਆ ਉਸ ਜਨਗਣਨਾ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਨਾ ਹੀ ਗਲਤ ਅੰਕੜੇ ਜਨਗਣਨਾ ਵਿੱਚ ਸ਼ੋਅ ਹੋਣ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਆਪਣੀ ਜਿਹੜੀ ਤੁਸੀਂ ਡੁਬਲੀ ਰਜਿਸਟ੍ਰੇਸ਼ਨ ਕਰਵਾਈ ਸੀ ਉਨ੍ਹਾਂ ਨੂੰ ਤੁਸੀਂ ਰੱਦ ਕਰਵਾ ਦਿਉ ਧੰਨਵਾਦ